ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਡੋਕਟਰ ਤੁਸੀਂ ਰਜਿੰਦਰਾ ਹੋਸਪਿਟਲ ਤੋਂ ਬੋਲ ਰਹੇ ਹੋ ਜੀ ਹਾਂਜੀ ਮੈਮ ਹਾਂਜੀ ਮੈਨੂੰ ਨਾ ਥੋੜ੍ਹੀ ਪ੍ਰੋਬਲਮ ਸੀਗੀ ਮੈਂ ਆਪਣਾ ਨਾ ਇਲਾਜ ਕਰਵਾਉਣਾ ਸੀਗਾ ਮੈਨੂੰ ਤੁਸੀਂ ਦੱਸ ਸਕਦੇ ਹੋ ਕਿ ਰਜਿੰਦਰਾ ਹੋਸਪਿਟਲ ਵਿੱਚ ਦਵਾਈਆਂ ਹੋ ਗਈਆਂ ਜਿਵੇਂ ਟੈਸਟ ਵਗੈਰਾ ਹੋ ਗਏ ਕੀ ਕੀ ਸੁਵਿਧਾਵਾਂ ਹਨ ਮੈਨੂੰ ਦੱਸ ਸਕਦੇ ਹੋ ਤੁਸੀਂ

ਠੀਕ ਹੈ ਠੀਕ ਹੈ ਮੈਮ ਅਸੀਂ ਸਾਨੂੰ ਨਾ ਤੁਹਾਡੇ ਤੋਂ ਬਹੁਤ ਵਧੀਆ ਜਾਣਕਾਰੀ ਮਿਲੀ ਮੈਮ ਇਸ ਲਈ ਅਸੀਂ ਆਪਣਾ ਇਲਾਜ ਕਰਨ ਲਈ ਪਹਿਲਾਂ ਆਪਣੀ ਫੈਮਲੀ ਨਾਲ ਸਲਾਹ ਕਰਕੇ ਫਿਰ ਤੁਹਾਡੇ ਹੋਸਪਿਟਲ ਵਿੱਚ ਹੀ ਆਪਣਾ ਇਲਾਜ ਸ਼ੁਰੂ ਕਰ ਦੇਵਾਂਗੇ ਜੀ ਹਾਂਜੀ ਹਾਂਜੀ ਠੀਕ ਹੈ ਮੈਮ ਥੈਂਕ ਯੂ ਜੀ ਆਪਣੀ ਜਾਣਕਾਰੀ ਦੇਣ ਲਈ ਓਕੇ ਜੀ